ਯੋਗਾ ਕਰਨ ਦੇ ਨਾਲ ਜਦੋਂ ਸਾਡਾ ਸਰੀਰ ਚੁਸਤ ਫਰੁਸਤ ਦਰੁਸਤ ਅਤੇ ਸਵੱਛ ਰਹੇਗਾ ਤਾਂ ਅਸੀਂ ਆਪਣੇ ਆਪ ਹੀ ਅਪ ਤਨਾਵ ਤੋਂ ਦੂਰ ਹੋ ਜਾਵਾਂਗੇ ਕਈ ਕਈ ਐਸੇ ਅਜ ਅਜਿਹੇ ਆਸਨ ਹਨ ਜਿਹਨਾਂ ਤੋਂ ਅਸੀਂ ਤਨਾਵ ਮੁਕਤ ਹੋ ਜਾਂਦੇ ਹਾਂ ਸਾਡਾ ਸਰੀਰ ਜਿਹੜਾ ਹੈ ਤਨਾਅ ਤੋਂ ਦੂਰ ਰਹਿੰਦਾ ਹੈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਅਸੀਂ ਤਾਜ਼ਗੀ ਮਹਿਸੂਸ ਕਰਾਂਗੇ ਫਰੈਸ਼ ਰਹਾਂਗੇ ਤਾਂ ਆਪਣੇ ਆਪ ਨੂੰ ਠੀਕ ਸੁਡੋਲ ਰੱਖ ਸਕਦੇ ਹਾਂ ਯੋਗਾ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਚੁਸਤ ਫਰੁਸਤ ਰੱਖਣ ਦੀ ਕਾਬਲੀਅਤ ਬਖਸ਼ਦਾ ਹੈ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਯੋਗ ਆਸਨ ਜਿਹੜੇ ਹਨ ਇਹ ਸਾਡੇ ਸਰੀਰ ਨੂੰ ਲਚਕੀਲਾ ਵੀ ਬਣਾਉਂਦੇ ਹਨ ਅਜਿਹੇ ਅਜਿਹੇ ਆਸਨ ਹਨ ਜਿਹਨਾਂ ਨਾਲ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ ਕਈ ਬਿਮਾਰੀਆਂ ਤੋਂ ਮੁਕਤੀ ਪਾ ਸਕਦੇ ਹਨ ਸਾਡੇ ਪਰਟੀਕੂਰਲੀ ਜਿਹੜੀ ਪ੍ਰੋਬਲਮ ਹੈ ਉਹ ਹੈ ਕਿ ਅਸੀਂ ਤਨਾਅ ਪੂਰਨ ਲੈਦੇ ਹਾਂ ਔਰ ਉਹ ਤਨਾਵ ਪੂਰਨ ਜਿਹੜਾ ਹੈ ਉਹ ਸਾਡਾ ਬਿਮਾਰੀਆਂ ਨੂੰ ਹੋਰ ਵਧਾਉਂਦਾ ਹੈ ਚਿੰਤਾਵਾਂ ਚਿਤਾ ਦੇ ਸਮਾਨ ਹਨ ਇਸ ਲਈ ਸਾਨੂੰ ਚਿੰਤਾਵਾਂ ਨੂੰ ਦੂਰ ਕਰਨਾ ਪਏਗਾ ਔਰ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਸਾਨੂੰ ਯੋਗ ਦਾ ਸਹਾਰਾ ਲੈਣਾ ਚਾਹੀਦਾ ਹੈ ਇਹਨਾਂ ਆਸਨਾਂ ਨੂੰ ਕਰਕੇ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਕਰ ਸਕਦੇ ਹਾਂ ਆਪਣੇ ਆਪ ਨੂੰ ਸਰੀਰਕ ਪੱਖੋਂ ਤੰਦਰੁਸਤ ਅਤੇ ਚੁਸਤ ਫਰੁਸਤ ਰੱਖ ਸਕਦੇ ਹਾਂ ਧੰਨਵਾਦ